ਮੈਂ ਚੰਡੀਗੜ੍ਹ ਜਾਣ ਲਈ ਇੱਕ ਤੁਹਾਡੀ ਉਬਰ ਤੋਂ ਕੈਬ ਔਡਰ ਕੀਤੀ ਸੀ ਕੈਬ ਬੁੱਕ ਕੀਤੀ ਸੀ ਕੈਬ ਦੇ ਵਿੱਚ ਮੈਂ ਲਿਖਿਆ ਸੀ ਕਿ ਮੈਂ ਚੰਡੀਗੜ੍ਹ ਜਾਣਾ ਹੈ ਮਲੋਟ ਤੋਂ ਪਰ ਉਸ ਉਸ ਦੇ ਵਿੱਚ ਕੀ ਸੀ ਕਿ ਉਹਦੇ ਵਿੱਚ ਮੈਂ ਆਪ ਦੀ ਪੇਮੈਂਟ ਕਰ ਦਿੱਤੀ ਸੀ ਪਰ ਪੇਮੈਂਟ ਕਰ ਤਾਂ ਦਿੱਤੀ ਸੀ ਪਰ ਉਹਦੇ ਵਿੱਚ ਕੀ ਸੀ ਮੈਂ ਹੁਣ ਜਾ ਨਹੀਂ ਸਕਦੀ ਮੈਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਪੈ ਗਿਆ ਹੈ ਪਲੀਜ਼ ਕਿਰਪਾ ਕਰਕੇ ਤੁਸੀਂ ਮੈਨੂੰ ਮੇਰੇ ਜੋ ਵੀ ਪੈਸੇ ਹਨ ਉਹ ਵਾਪਿਸ ਕੀਤੇ ਜਾਣ ਜਾਂ ਤਾਂ ਮੈਨੂੰ ਹਾਫ ਫਿਫਟੀ ਪ੍ਰਸੈਂਟ ਰਿਫੰਡ ਕੀਤਾ ਜਾਵੇ ਜੇਕਰ ਹੋ ਸਕੇ ਤਾਂ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਰਿਫੰਡ ਕੀਤਾ ਜਾਵੇ ਜਿਸ ਦੇ ਨਾਲ ਕਿ ਮੈਨੂੰ ਉਸ ਐਪ ਦੇ ਨਾਲ ਸੈਟਿਸਫੈਕਸ਼ਨ ਹੋ ਸਕੇ ਉਹਦੇ ਵਿੱਚ ਕੀ ਹੈ ਕਿ ਮੈਨੂੰ ਹਰ ਚੀਜ਼ ਦੇ ਨਾਲ ਤੁਹਾਡੀ ਜੋ ਸੇਵਾਵਾਂ ਹਨ ਉਹ ਸਹੀ ਲੱਗਣਗੀਆਂ ਤਾਂ ਅਗਲੀ ਵਾਰ ਵੀ ਮੈਂ ਤੁਹਾਡੇ ਨਾਲ ਹੀ ਜੁੜੀ ਰਹਾਂਗੀ ਤਾਂ ਇਸ ਕਰਕੇ ਮੈਨੂੰ ਮੈਂ ਹੁਣ ਦੁਬਾਰਾ ਵੀ ਜਾਣਾ ਹੈ ਅੰਮ੍ਰਿਤਸਰ ਤਾਂ ਉਹਦੇ ਕਰਕੇ ਵੀ ਮੈਂ ਇੱਕ ਵਾਰ ਫਿਰ ਕੈਬ ਬੁੱਕ ਕਰਾਂਗੀ ਤੁਸੀਂ ਕਿਰਪਾ ਕਰਕੇ ਮੇਰੇ ਜੋ ਵੀ ਪੈਸੇ ਹਨ ਉਹ ਰਿਫੰਡ ਕਰ ਦਿੱਤੇ ਜਾਣ ਰਿਫੰਡ ਕਰ ਦਿੱਤੇ ਜਾਣਗੇ ਤਾਂ ਉਹਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇਗਾ ਮੇਰੇ ਕਿਉਂਕਿ ਥੋੜ੍ਹੇ ਨਹੀਂ ਸਨ ਮੇਰੇ ਇਕ ਹਜ਼ਾਰ ਰੁਪਿਆ ਸੀ ਇੱਕ ਹਜ਼ਾਰ ਰੁਪਏ ਦੇ ਵਿੱਚੋਂ ਤੁਸੀਂ ਮੈਨੂੰ ਘੱਟੋ ਘੱਟ ਸੱਤ ਸੌ ਰੁਪਏ ਵਾਪਿਸ ਕਰ ਦਿਓ ਜਾਂ ਫਿਰ ਮੈਨੂੰ ਮੇਰੇ ਪੈਸੇ ਵਾਪਸ ਕਰੋ ਜਾਂ ਫਿਰ ਅਗਲੀ ਵਾਰੀ ਤੁਸੀਂ ਰਿਫੰਡ ਕਰ